ਮੈਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਸਮੇਂ ਦੀ ਕਦਰ ਹੈ ਕਿਉਂਕਿ ਸਮੇਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਹਰ ਇਨਸਾਨ ਦੇ ਲਈ ਮੈਨੂੰ ਆਪਣਾ ਹਰ ਕਰ ਕੰਮ ਸਮੇਂ ਉੱਤੇ ਪਸੰਦ ਹੈ ਅੱਜ ਦੇ ਸਮੇਂ ਵਿੱਚ ਮੈਨੂੰ ਇੰਝ ਲੱਗਦਾ ਜਿਵੇਂ ਪੈਸੇ ਦਾ ਮਹੱਤਵ ਹੈ ਉਨ੍ਹਾਂ ਹੀ ਸਮੇਂ ਦਾ ਮਹੱਤਵ ਹੈ